ਸਤਿ ਸ਼੍ਰੀ ਅਕਾਲ ਜੀ ਮੈਂ ਭਾਵੀਕਾ ਜ਼ਿਲ੍ਹਾ ਨਿਵਾਸੀ ਪਠਾਨਕੋਟ ਤੋਂ ਬੋਲ ਰਹੀ ਹਾਂ ਅੱਜ ਮੈਂ ਤੁਹਾਨੂੰ ਆਪਣੀ ਮਨਪਸੰਦ ਕਿਤਾਬ ਬਾਰੇ ਦੱਸਾਂਗੀ ਮੇਰੀ ਮਨਪਸੰਦ ਕਿਤਾਬ ਸ਼੍ਰੀ ਏ ਪੀ ਜੇ ਅਬਦੁਲ ਕਲਾਮ ਜੀ ਦੀ ਜੀਵਨੀ ਹੈ ਇਸ ਵਿੱਚ ਅਬਦੁਲ ਕਲਾਮ ਜੀ ਦੇ ਜਨਮ ਤੋਂ ਮਰਨ ਤੱਕ ਦੀ ਹਰ ਇੱਕ ਗੱਲ ਬਾਰੇ ਦੱਸਿਆ ਗਿਆ ਹੈ ਉਹਨਾਂ ਦੇ ਜਨਮ ਕਦੋਂ ਅਤੇ ਕਿੱਥੇ ਹੋਇਆ ਉਹਨਾਂ ਨੇ ਆਪਣੀ ਸਕੂਲਿੰਗ ਕਿੱਥੇ ਕੀਤੀ ਆਪਣੇ ਸਕੂਲ ਖਤਮ ਕਰਨ ਤੋਂ ਬਾਅਦ ਆਪਣੀ ਸਕੋਲਰਸ਼ਿਪ ਦੇ ਬੇਸਿਸ 'ਤੇ ਉਹਨਾਂ ਉਹ ਆਪਣੇ ਉੱਚ ਸਿਕਸ਼ਾ ਪ੍ਰਾਪਤ ਕਰਨ ਲਈ ਬਾਹਰਲੇ ਮੁਲਕ ਵੀ ਗਏ ਉੱਥੋਂ ਉਹਨਾਂ ਨੇ ਐਰੋਸਪੇਸ ਇੰਜੀਨਿਰਿਗ ਕੀਤੀ ਅਤੇ ਫਿਰ ਉਹ ਜਦੋਂ ਭਾਰਤ ਵਾਪਸ ਆਏ ਤਾਂ ਉਹ ਇੱਕ ਬਹੁਤ ਹੀ ਮਹਾਨ ਵਿਗਿਆਨਿਕ ਬਣੇ ਇਹਨਾਂ ਨੇ ਇੱਥੇ ਆ ਕੇ ਬਹੁਤ ਹੀ ਜ਼ਿਆਦਾ ਅਵਿਸ਼ਕਾਰ ਕੀਤੇ ਉਹਨਾਂ ਵਿੱਚੋਂ ਇਹਨਾਂ ਨੇ ਤਿੰਨ ਅਵਿਸ਼ਕਾਰ ਭਾਰਤ ਲਈ ਬਹੁਤ ਹੀ ਫਾਇਦੇਮੰਦ ਸੀ ਕਿਉਂਕਿ ਇਹਨਾਂ ਨੇ ਭਾਰਤ ਦਾ ਨਾਮ ਰੌਸ਼ਨ ਕੀਤਾ ਸੀ ਇਹ ਤਿੰਨ ਅਵਿਸ਼ਕਾਰ ਤਿੰਨ ਮਿਸਾਲ ਸੀ ਮਿਸਾਇਲ ਸੀ ਜੋ ਕਿ ਅਗਨੀ ਧਰਤੀ ਅਤੇ ਵਾਯੂ ਸੀ ਜਿਹਨਾਂ ਦਾ ਭਾਰਤ ਸਰਕਾਰ ਨੇ ਸਫਲਤਾ ਪੂਰਵਕ ਪੋਖਰਨ ਰਾਜਸਥਾਨ ਵਿੱਚ ਪ੍ਰੇਸ਼ਨ ਕੀਤਾ ਇਸ ਤੋਂ ਸਾਨੂੰ ਇਹ ਸਿਕਸ਼ਾ ਮਿਲਦੀ ਹੈ ਕਿ ਸਾਨੂੰ ਹਮੇਸ਼ਾ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ ਕਦੀ ਵੀ ਹਾਰ ਨਹੀਂ ਮੰਨਣੀ ਚਾਹੀਦੀ